ਮੈਂ ਉਸ ਟਾਈਮ ਦੀ ਗੱਲ ਹੈ ਜਦੋਂ ਮੈਂ ਸਕੂਲ 'ਚ ਪੜ੍ਹਦਾ ਸੀ ਅਤੇ ਸਾਡੇ ਸਕੂਲ 'ਚ ਇੱਕ ਫੰਕਸ਼ਨ ਸੀਗਾ ਉਹਦੇ ਵਿੱਚ ਮਿਊਜ਼ਿਕ ਵਾਲੇ ਸਾਡੇ ਜਿਹੜੇ ਟੀਚਰ ਸੀਗੇ ਉਹਨਾਂ ਨੇ ਜਿਨ੍ਹਾਂ ਦੀ ਡਿਊਟੀ ਲਾਈ ਸੀਗੀ ਸਟੂਡੈਂਟ ਦੀ ਬਈ ਤੂੰ ਇਹ ਗੀਤ ਬੋਲਣਾ ਹੈਗਾ ਉਹ ਉਸ ਟਾਈਮ 'ਤੇ ਠੀਕ ਨਹੀਂ ਸੀ ਬਿਮਾਰ ਹੋ ਗਿਆ ਸੀਗਾ ਅਤੇ ਉਸ ਵੇਲੇ ਸਾਡੇ ਟੀਚਰਾਂ ਨੇ ਕਿਹਾ ਕਿ ਤੁਸੀਂ ਜਿਹੜਾ ਕੋਈ ਔਰ ਸਟੂਡੈਂਟ ਦੱਸੋ ਜਿਹੜਾ ਬੋਲ ਸਕਦਾ ਹੋਵੇ ਜਾਂ ਗਾ ਗਾ ਸਕਦਾ ਹੋਵੇ ਗੀਤ ਹੋਵੇ ਜਾਂ ਕੋਈ ਹੋਰ ਉਹਦੇ ਵਿੱਚ ਫਿਰ ਮੇਰਾ ਇੱਕ ਨਾਂ ਟੀਚਰ ਨੇ ਮੇਰਾ ਨਾਂ ਪੇਸ਼ ਕੀਤਾ ਅਤੇ ਮੈਂ ਬੜਾ ਚਿੰਤਾ 'ਚ ਪੈ ਗਿਆ ਕਿ ਮੈਂ ਕਦੀ ਗਾਇਆ ਨਹੀਂ ਗਾ ਅਤੇ ਮੈਨੂੰ ਇਹਨਾਂ ਨੇ ਬੁਲਾ ਲਿਆ ਹੈ ਸਟੇਜ ਦੇ ਉੱਤੇ ਫਿਰ ਮੇਰੇ ਕੋਲ ਦੋ ਦੋਸਤ ਹੈਗੇ ਉਹਨਾਂ ਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਤੁਸੀਂ ਚਲੋ ਅਤੇ ਗਾਓ ਕੋਈ ਗੱਲ ਨਹੀਂ ਉਹਨਾਂ ਮੈਨੂੰ ਹੌਸਲਾ ਦਿੱਤਾ ਅਤੇ ਮੈਂ ਕਦੀ ਪਹਿਲੀ ਵਾਰੀ ਇਸ ਤਰ੍ਹਾਂ ਗਾਇਕ ਦੇ ਤੌਰ 'ਤੇ ਨਾ ਇੱਕ ਗਾਣਾ ਜਿਹੜਾ ਪੇਸ਼ ਕੀਤਾ ਫਿਲਮ ਦਾ ਸੀਗਾ ਚੌਦਵੀਂ ਕਾ ਚਾਂਦ ਹੋ ਜਾ ਆਫਤਾਬ ਹੋ ਜੋ ਵੀ ਹੋ ਤੁਮ ਖੁਦਾ ਕੀ ਕਸਮ ਲਾਜਵਾਬ ਹੋ ਉਹ ਫਿਰ ਸਾਰਿਆਂ ਨੇ ਤਾੜੀਆਂ ਮਾਰੀਆਂ ਪ੍ਰਸ਼ੰਸਾ ਕੀਤੀ ਮੈਨੂੰ ਵੀ ਥੋੜ੍ਹੀ ਖੁਸ਼ੀ ਹੋਈ ਕਿ ਮੇਰਾ ਵੀ ਹੌਸਲਾ ਵਧਿਆ